ਹੈਲੋ ਮੈਮ ਹਾਵ ਯੂ ਫਾਈਨ ਆਈ ਐਮ ਥੈਂਕ ਥੈਂਕ ਯੂ ਮੈਮ ਮੈਂ ਤੁਹਾਡੇ ਇੱਥੋਂ ਨਾ ਇੱਕ ਜੈਕਟ ਆਨਲਾਈਨ ਮੰਗਵਾਈ ਸੀ ਹੈ ਨਾ ਅਤੇ ਮੈਂ ਥੋੜ੍ਹੇ ਦਿਨ ਪਹਿਲੇ ਕੱਲ੍ਹ ਪਰਸੋਂ ਵੀ ਮੰਗਵਾਈ ਸੀ ਮੇਰੇ ਕੋਲ ਤੁਹਾਡਾ ਪਾਰਸਲ ਪਹੁੰਚ ਗਿਆ ਬਟ ਉਹ ਜੈਕਟ ਨਾ ਬਹੁਤ ਜ਼ਿਆਦਾ ਨਾ ਵੱਡੀ ਆ ਗਈ ਹੈ ਬਹੁਤ ਵੱਡੀ ਜ਼ਿਆਦਾ ਆ ਗਈ ਮੈਂ ਪਾ ਕੇ ਵੀ ਦੇਖੀ ਉਹਦੀ ਮੈਂ ਆਪਣੇ ਆਪ ਤੇ' ਪਾ ਕੇ ਤੁਹਾਨੂੰ ਵੀਡੀਓ ਵੀ ਸੈਂਡ ਕਰੀ ਹੈ ਜਿਹੜੇ ਤੁਹਾਡੇ ਨੰਬਰ ਸੀ ਮੇਰੇ ਕੋਲ ਸੋ ਮੈਂ ਚਾਹੁੰਦੀ ਹਾਂ ਕਿ ਉਹ ਜੈਕਟ ਤੁਸੀਂ ਮਤਲਬ ਮੇਰੇ ਸਾਈਜ਼ ਦੀ ਮੈਨੂੰ ਭੇਜ ਦਿਓ ਠੀਕ ਹੈ ਮੈਮ ਮੈਂ ਮਤਲਬ ਉਹ ਹੀ ਰੇਟ ਦੇ ਵਿੱਚ ਉਨੀ ਪੈਸਿਆਂ ਦੇ ਵਿੱਚ ਉਹ ਜੈਕਟ ਮੇਰੀ ਐਕਸਚੇਂਜ ਕਰ ਲਓ ਤਾਂ ਬਹੁਤ ਵਧੀਆ ਹੈ ਕਿਉਂਕਿ ਮੈਨੂੰ ਪੀਸ ਤੁਹਾਡਾ ਬਹੁਤ ਅੱਛਾ ਲੱਗਾ ਆ ਬਹੁਤ ਵਧੀਆ ਲੱਗਿਆ ਆ ਮੈਂ ਨਹੀਂ ਚਾਹੁੰਦੀ ਕਿ ਮਤਲਬ ਮੈਂ ਇਸ ਜੈਕਟ ਨੂੰ ਗਵਾਵਾਂ ਸੋ ਇਸ ਕਰਕੇ ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਕਿ ਤੁਸੀਂ ਇਸ ਐਕਸਚੇਂਜ ਔਫਰ ਨੂੰ ਮਤਲਬ ਮੇਰੀ ਰਿਕੁਐਸਟ ਨੂੰ ਕਬੂਲ ਕਰੋ ਅਤੇ ਮੈਨੂੰ ਉਸ ਸਾਈਜ਼ ਦੇ ਵਿੱਚ ਛੋਟੀ ਜੈਕਟ ਮੈਨੂੰ ਭੇਜ ਦਿਓ ਔਰ ਉਹ ਹੀ ਐਡਰੈਸ ਆ ਉਹ ਹੀ ਸੇਮ ਰੇਟ ਦੇ ਵਿੱਚ ਤਾਂ ਬਹੁਤ ਤੁਹਾਡੀ ਮਿਹਰਬਾਨੀ ਹੋਵੇਗੀ ਆਈ ਐਮ ਵੈਰੀ ਵੈਰੀ ਵੈਰੀ ਥੈਂਕਫੁਲ ਟੂ ਯੂ ਓਕੇ ਮੈਮ